ਭਾਰਤ ਵਿੱਚ ਹਰ ਇੱਕ ਤਰ੍ਹਾਂ ਦਾ ਭੋਜਨ ਉਪਲਬਧ ਹੈ ਅਤੇ ਵੱਖ ਵੱਖ ਸ਼ਹਿਰਾਂ ਦੇ ਹਿਸਾਬ ਨਾਲ ਭੋਜਨ ਉਪਲਬਧ ਹੈ ਮੈਂ ਗੱਲ ਕਰਾਂਗਾ ਪੰਜਾਬ ਦੀ ਪੰਜਾਬ ਜਾਣਿਆਂ ਜਾਂਦਾ ਖਾਣ ਪੀਣ ਦੇ ਨਾਲ ਅਤੇ ਅਸ ਇਹਦੇ ਵਿੱਚ ਬਹੁਤ ਭੋਜਨ ਮਸ਼ਹੂਰ ਹਨ ਜੋ ਇੱਥੇ ਬਹੁਤ ਹੀ ਪ੍ਰਸਿੱਧ ਪਕਵਾਨ ਮਸ਼ਹੂਰ ਨੇ ਜਿਵੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਕੜੀ ਚੌਲ ਹੋ ਗਏ ਰਾਜਮਾਂਹ ਚੌਲ ਇਹ ਚੀਜ਼ਾਂ ਬਹੁਤ ਪ੍ਰਸਿੱਧ ਨੇ ਇੱਥੋਂ ਦੀਆਂ ਅਤੇ ਰੋਜਾਨਾ ਜੀਵਨ ਵਿੱਚ ਅਸੀਂ ਜਿਹੜੇ ਮਸਾਲੇ ਵਰਤਦੇ ਹਾਂ ਹਲਦੀ ਲਾਲ ਮਿਰਚ ਹਰੀ ਮਿਰਚ ਸੁੱਕਾ ਧਨੀਆ ਗਰਮ ਮਸਾਲੇ ਇਹ ਹਨ ਜੀ ਧੰਨਵਾਦ